ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੀਸ਼ੋ ਤੋਂ ਬੋਲ ਰਹੇ ਹੈ ਜੀ ਹਾਂਜੀ ਮੈਂ ਨਾ ਵੀਹ ਦਿਨ ਪਹਿਲਾਂ ਜੀ ਲੈਪਟੋਪ ਮੰਗਵਾਇਆ ਸੀ ਜੀ ਆਪਣਾ ਲੈਪਟਾਪ ਮੇਰੇ ਘਰ ਪਹੁੰਚ ਗਿਆ ਜੀ ਉਹਦੀ ਪੈਕਿੰਗ ਏ ਬਹੁਤ ਸੋਹਣੀ ਆ ਜੀ ਬਹੁਤ ਵਧੀਆ ਲੱਗਿਆ ਜੀ ਸਾਨੂੰ ਦੇਖ ਕੇ ਜੀ ਅਤੇ ਜਦੋਂ ਚਲਾਇਆ ਜੀ ਅਸੀਂ ਬਹੁਤ ਵਧੀਆ ਚੱਲ ਰਿਹਾ ਜੀ ਉਹ ਉਹ 'ਚ ਲਾਈਟਾਂ ਅਤੇ ਕੀਬੋਰਡ 'ਚ ਲਾਈਟਾਂ ਬਹੁਤ ਵਧੀਆ ਲੱਗੀਆਂ ਹੋਈਆਂ ਜੀ ਠੀਕ ਆ ਜੀ ਬਹੁਤ ਵਧੀਆ ਜੀ ਜਿਹੜਾ ਸਾਨੂੰ ਜੀ ਬਾਹਰੋਂ ਪੰਜਾਹ ਹਜ਼ਾਰ ਦਾ ਮਿਲਦਾ ਜੀ ਸਾਨੂੰ ਉੱਥੋਂ ਚਾਲੀ ਹਜ਼ਾਰ ਦਾ ਮਿਲਿਆ ਜੀ ਬਹੁਤ ਵਧੀਆ ਲੱਗਿਆ ਜੀ ਮੈਨੂੰ ਮੀਸ਼ੋ ਤੋਂ ਮੰਗ ਮੰਗਾ ਕੇ ਫਲਿੱਪਕਾਰਟ ਤੋਂ ਜੀ ਹਾਂਜੀ ਸਰ ਬਹੁਤ ਤੁਹਾਡਾ ਧੰਨਵਾਦ ਜੀ ਅਤੇ ਅਗਾਂਹ ਨੂੰ ਵੀ ਮੈਂ ਥੋਤੋਂ ਇਹ ਚੀਜ਼ ਮੰਗਾਵਾਂਗਾ ਜੀ ਅਤੇ ਵੱਧ ਤੋਂ ਵਧੀਆ ਲੱਗਿਆ ਜੀ ਮੈਨੂੰ ਬਹੁਤ ਹਾਂਜੀ